ਹੁਣ ਤੱਕ ਮੈਂ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਅਤੇ ਬਹੁਤ ਹੀ ਯਾਦਗਾਰ ਰਹੀਆਂ ਪਰ ਮੈਂ ਆਪਣੀ ਇੱਕ ਯਾਤਰਾ ਤੁਹਾਡੇ ਨਾਲ਼ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਪਿਛਲੇ ਦਿਨੀਂ ਜਦੋਂ ਮੈਂ ਕਸ਼ਮੀਰ ਗਿਆ ਮੈਨੂੰ ਬਹੁਤ ਹੀ ਸੁੰਦਰ ਜਿਹੜਾ ਅਨੁਭਵ ਹੋਇਆ ਜਾ ਕੇ ਲੱਗਿਆ ਪਹਿਲਾਂ ਕਸ਼ਮੀਰ ਬਾਰੇ ਸੁਣਿਆ ਸੀਗਾ ਪੜ੍ਹਿਆ ਸੀਗਾ ਪਰ ਜਦੋਂ ਖੁਦ ਮੈਂ ਜਾ ਕੇ ਉੱਥੇ ਯਾਤਰਾ ਕੀਤੀ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਿਆ ਅਨੁਭਵ ਲੱਗਿਆ ਅਤੇ ਇਸ ਤਰ੍ਹਾਂ ਲੱਗਿਆ ਬਈ ਜਿਸ ਤਰ੍ਹਾਂ ਬੰਦਾ ਇੱਕ ਸੋਚਦਾ ਇੱਕ ਅਲੱਗ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਅਨੁਭਵ ਕੀਤਾ ਅਤੇ ਉੱਥੇ ਦੇ ਪਹਾੜੀ ਨਜ਼ਾਰੇ ਖਾਸ ਕਰਕੇ ਜਿਹੜਾ ਸੂਰਜ ਚੜ੍ਹਨਾ ਅਤੇ ਡੁੱਬਣਾ ਉਹ ਅਦਭੁਤ ਨਜ਼ਾਰਾ ਸੀ ਅਤੇ ਬਹੁਤ ਹੀ ਦੇਖ ਕੇ ਮਨ ਨੂੰ ਸੰਤੁਸ਼ਟੀ ਮਿਲੀ ਅੱਖਾਂ ਨੂੰ ਚੰਗਾ ਲੱਗਿਆ ਅਤੇ ਕਸ਼ਮੀਰ ਦੀਆਂ ਵਾਦੀਆਂ ਖਾਸ ਕਰਕੇ ਡੱਲ ਝੀਲ ਦਾ ਜਿਹੜਾ ਨਜ਼ਾਰਾ ਆ ਉਹ ਸ਼ਾਇਦ ਦੁਨੀਆਂ ਦੇ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਅਤੇ ਉਹ ਦੇਖ ਕੇ ਬਹੁਤ ਹੀ ਚੰਗਾ ਲੱਗਿਆ ਅਤੇ ਖਾਸ ਕਰਕੇ ਕਸ਼ਮੀਰੀ ਲੋਕਾਂ ਦਾ ਪਹਿਰਾਵਾ ਰਹਿਣ ਸਹਿਣ ਕਾਫ਼ੀ ਪ੍ਰਭਾਵਿਤ ਕਰਦਾ ਹੈ ਕਿਉਂਕਿ ਉਹ ਬੜੇ ਪਹਾੜੀ ਏਰੀਏ ਵਿੱਚ ਮੁਸ਼ਕਲ ਏਰੀਏ ਦੇ ਵਿੱਚ ਰਹਿ ਕੇ ਵੀ ਬਹੁਤ ਚੰਗਾ ਆਪਣੇ ਜੀਵਨ ਜਾਂਚ ਕਰ ਰਹੇ ਨੇ ਅਤੇ ਸਾਡੇ ਵਰਗਾ ਜਿਹੜਾ ਉੱਥੇ ਜਾ ਕੇ ਦੇਖਦਾ ਤਾਂ ਉਹਨੂੰ ਬੜੇ ਹੀ ਖੂਬਸੂਰਤ ਜਿਹੜਾ ਵਾਦੀ ਹੈ ਅਤੇ ਮਨ ਨੂੰ ਬਹੁਤ ਚੰਗਾ ਲੱਗਦਾ ਅਤੇ ਮੇਰੇ ਲਈ ਕਸ਼ਮੀਰ ਦੀ ਯਾਤਰਾ ਇੱਕ ਯਾਦਗਾਰ ਬਣ ਗਈ ਖਾਸ ਕਰਕੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਜਿਹੜਾ ਵੀ ਬੇਸ਼ੱਕ ਦੁਨੀਆਂ ਦੇ ਵਿੱਚ ਇੱਕੋ ਹੀ ਸੂਰਜ ਚੜ੍ਹਦਾ ਆ ਅਤੇ ਡੁੱਬਦਾ ਪਰ ਜਿਹੜਾ ਕਸ਼ਮੀਰ ਦਾ ਸੂਰਜ ਚੜ੍ਹਨ ਦਾ ਇੱਕ ਅਲੱਗ ਨਜ਼ਾਰਾ ਹੈ ਇਸ ਤਰ੍ਹਾਂ ਡੁੱਬਣ ਦਾ ਵੀ ਬਹੁਤ ਹੀ ਖੂਬਸੂਰਤ ਜਿਹੜਾ ਨਜ਼ਾਰਾ ਪੇਸ਼ ਕਰਦਾ ਹੈ